ਹੈਲੋ ਜੀ ਤੁਸੀਂ ਜੱਗੀ ਸਵੀਟਸ ਤੋਂ ਗੱਲ ਕਰ ਰਹੇ ਸੀਗੇ ਐਕਚਲੀ ਨਾ ਛੁੱਟੀ ਦਾ ਦਿਨ ਸੀਗਾ ਅਤੇ ਅਸੀਂ ਪਤਾ ਕਰਨਾ ਸੀਗਾ ਵੀ ਤੁਹਾਡੇ ਰੈਸਟੋਰੈਂਟ 'ਚ ਛੁੱਟੀ ਤਾਂ ਨਹੀਂ ਹੈਗੀ ਅਗਰ ਛੁੱਟੀ ਨਹੀਂ ਹੈਗੀ ਤਾਂ ਪਲੀਜ਼ ਸਾਡਾ ਔਡਰ ਲਿਖ ਲਵੋ ਅਤੇ ਆ ਇਹ ਔਡਰ ਨਾ ਸਾਨੂੰ ਅੱਜ ਇੱਕ ਵਜੇ ਤੱਕ ਜ਼ਰੂਰ ਚਾਹੀਦਾ ਹੈ ਕਿਉਂਕਿ ਮੇਰੇ ਘਰ ਕੁਛ ਗੈਸਟਾਂ ਨੇ ਆਉਣਾ ਸੀਗਾ ਅਤੇ ਮੈਨੂੰ ਔਡਰ ਮੈਂ ਇਹੀ ਦੇਣਾ ਸੀਗਾ ਕਿ ਕੁਝ ਕਿ ਪੇਸਟੀ ਪੇਸਟੀ ਅਤੇ ਸਮੋਸੇ ਬਰ ਉਹ ਬਰਗਰ ਗੁਲਾਬ ਜਾਮਣ ਗੁਲਾਬ ਜਾਮਣ ਅਤੇ ਰਸਗੁੱਲਾ ਇਹ ਸਾਰੀਆਂ ਆਈਟਮਾਂ ਮੈਨੂੰ ਇੱਕ ਵਜੇ ਤੱਕ ਚਾਹੀਦੀਆਂ ਨੇ ਦੁਪਹਿਰੇ ਅਤੇ ਤੁਸੀਂ ਪਲੀਜ਼ ਮੇਰਾ ਇਹ ਔਡਰ ਫਿਰ ਤੁਸੀਂ ਇੱਕ ਵਜੇ ਤੱਕ ਪਲੀਜ਼ ਉਪੜਦਾ ਕਰ ਦਿਓ ਮੇਰਾ